ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਬਿੱਲੀ ਪਾਲੀ ਸੀ ਉਹ ਬਿੱਲੀ ਬਹੁਤ ਛੋਟੀ ਜਿਹੀ ਸੀ ਜਦੋਂ ਅਸੀਂ ਉਸਨੂੰ ਘਰ ਲਿਆਏ ਸੀ ਉਹ ਹੈ ਉਹ ਬਹੁਤ ਹੀ ਸੋਹਣੀ ਸੀ ਅਤੇ ਉਹ ਸਾਨੂੰ ਉਸ ਨੂੰ ਅਸੀਂ ਕੌਲੀ ਵਿੱਚ ਦੁੱਧ ਪਿਆਉਂਦੇ ਸੀ ਉਹ ਸਾਨੂੰ ਬਹੁਤ ਪਿਆਰ ਕਰਦੀ ਸੀ ਉਹ ਹੈ ਸਾਡੇ ਘਰ ਵਿੱਚ ਰਹਿ ਕੇ ਸਾਡੇ ਸਾਰੇ ਚੂਹੇ ਖਾ ਲੈਂਦੀ ਸੀ ਉਹ ਬਹੁਤ ਹੀ ਸੋਹਣੀ ਸੀ ਬਹੁਤ ਸਭ ਨੂੰ ਬਹੁਤ ਪਿਆਰ ਕਰਦੀ ਸੀ ਇਸੇ ਤਰ੍ਹਾਂ ਉਸ ਅਸੀਂ ਉਸ ਬਿੱਲੀ ਦਾ ਨਾਮ ਮਾਣੋਂ ਰੱਖਿਆ ਹੋਇਆ ਸੀ ਜਦੋਂ ਅਸੀਂ ਉਸ ਬਿੱਲੀ ਨੂੰ ਆਵਾਜ਼ ਲਗਾਉਂਦੇ ਤਾਂ ਉਹ ਭੱਜ ਕੇ ਸਾਡੇ ਪੈਰਾਂ ਕੋਲ ਆ ਜਾਂਦੀ ਸੀ ਇਸੇ ਤਰ੍ਹਾਂ ਇਸ ਅਸੀਂ ਕੁੱਤਾ ਵੀ ਰੱਖਿਆ ਹੋਇਆ ਸੀ ਜਿਸ ਦਾ ਨਾਂ ਟੋਮੀ ਸੀ ਉਹ ਵੀ ਬਹੁਤ ਸੋਹਣਾ ਸੀ ਇਸ ਉਹ ਕੁੱਤਾ ਸਿਰਫ ਦਸ ਸਾਲ ਹੀ ਸਾਡੇ ਕੋਲ ਰਿਹਾ ਉਸ ਤੋਂ ਬਾਅਦ ਉਸ ਉਹ ਹੈ ਮਰ ਗਿਆ ਸੀ ਪਰ ਉਹ ਬਹੁਤ ਹੀ ਪਿਆਰਾ ਸੀ ਉਹ ਸਾਡੇ ਕੋਲ ਸਾਨੂੰ ਬਹੁਤ ਲਾਡ ਚਾਅ ਕਰਦਾ ਸੀ ਕੁੱਤਾ ਜੋ ਹੈ ਬਹੁਤ ਵਫਾਦਾਰ ਸੀ ਉਹ ਸਾਡੇ ਘਰ ਦੀ ਰੱਖਿਆ ਕਰਦਾ ਸੀ ਸਾਨੂੰ ਉਸ ਕੁੱਤੇ ਅਤੇ ਉਸ ਬਿੱਲੀ ਨਾਲ ਬੜਾ ਹੀ ਪਿਆਰ ਸੀ ਉਹ ਸਾਨੂੰ ਬੜਾ ਮੋਹ ਕਰਦੇ ਸੀ ਉਹ ਸਾਡੇ ਨਾਲ ਬਹੁਤ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਸੀ ਉਹ ਸਾਡੇ ਘਰ ਦੇ ਮੈਂਬਰ ਤਰ੍ਹਾਂ ਸਨ ਅਤੇ ਸਾਡੇ ਮਿੱਤਰ ਵੀ ਸਨ ਸਾਨੂੰ ਉਹ ਹੈ ਬਹੁਤ ਚੰਗੇ ਲੱਗਦੇ ਸੀ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸੀ ਜਦੋਂ ਉਹ ਹੈ ਨਹੀਂ ਰਹੇ ਤਾਂ ਸਾਨੂੰ ਉਹ ਉਹਨਾਂ ਦੀ ਬੜੀ ਯਾਦ ਆਉਂਦੀ ਸੀ ਅਸੀਂ ਉਹ ਉਹ ਕੁੱਤੇ ਬਿੱਲੀ ਨੂੰ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਜਾਨਵਰ ਜੋ ਹੈ ਉਹ ਬਹੁਤ ਵਫਾਦਾਰ ਹੁੰਦੇ ਹਨ ਅਤੇ ਸਾਡੇ ਘਰ ਦੀ ਦੇਖਭਾਲ ਕਰਦੇ ਹਨ